ਹੈਲੋ ਸਰ ਸਰ ਜੀ ਸਰ ਮੈਂ ਮੀਡੀਆ ਨਿਊਜ਼ ਕੀ ਤਰਫ ਸੇ ਬੋਲ ਰਹਾ ਹੂੰ ਮੈਂ ਆਪਸੇ ਆਜ ਕੁਛ ਸਵਾਲ ਪੁਛਨਾ ਚਾਹਤਾ ਹੂੰ ਅਗਰ ਆਪ ਫਰੀ ਹੋ ਤੋ

ਸਰ ਜੀ ਆਪ ਪਹਿਲੇ ਹਮੇਂ ਬਤਾਈਏ ਤੁਸੀਂ ਦੱਸੋ ਸਾਨੂੰ ਪਹਿਲਾਂ ਕਿ ਤੁਹਾਡੀ ਤੁਹਾਡੇ ਸ਼ਹਿਰ 'ਚ ਕਿੰਨੀ ਕੁ ਵੱਡੀ ਜ਼ਿਆਦਾ ਸੁਵਿਧਾਵਾਂ ਖੋਲ੍ਹੀਆਂ ਗਈਆਂ ਨਵੀਆਂ ਨਵੀਆਂ

ਭਾਅ ਜੀ ਤੁਸੀਂ ਨਾ ਭਾਅ ਜੀ ਤੁਸੀਂ ਇੰਟਰਵਿਊ ਤਾਂ ਬੜਾ ਵਧੀਆ ਦੇਣਡੇ ਹੋ ਜੇ ਤੁਹਾਡੇ ਕੋਲ ਆਪਾਂ ਲਾਈਵ ਟੈਲੀਕਾਸਟ 'ਚ ਕਰਾਉਣਾ ਚਾਹੀਏ ਤਾਂ ਤੁਸੀਂ ਕਰੋਂਗੇ ਅਸੀਂ ਨਾ ਅਸੀਂ ਤੁਹਾਨੂੰ ਨਾ ਪਹਿਲਾਂ ਹੀ ਜਵਾਬ ਦੇ ਦਾਂਗੇ ਤਾਂ ਕਿ ਤੁਸੀਂ ਪਹਿਲਾਂ ਹੀ ਪ੍ਰੀਪੇਅਰ ਹੋ ਜਾਓ ਅਤੇ ਤੁਹਾਨੂੰ ਪੈਸੇ ਪੂਸੇ ਵੀ ਦੇ ਦਾਂਗੇ ਪਹਿਲਾਂ ਓਕੇ ਬਾਏ ਓਕੇ ਬਾਏ ਓਕੇ ਓ